ਹੈਲੋ ਨਹੀਂ ਨਹੀਂ ਤੁਸੀਂ ਕਿੰਨੇ ਪਰਸਨ ਹੈਗੇ ਹੋ ਜਾਣ ਵਾਲੇ ਜਿਆਦਾ ਤਾ ਚਾਰ ਜਿਹੜੇ ਨੇ ਜਾਣਾ ਫਿਰ ਤਾਂ ਤੁਸੀਂ ਛੋਟੀ ਗੱਡੀ ਤੇ ਜਾ ਸਕਦੇ ਛੋਟੀ ਗੱਡੀ ਕਰ ਲਓ ਜਿਆਦਾ ਵਧੀਆ ਰਹੇਗੀ ਨਾਲੇ ਸਸਤੀ ਪੈ ਜਾਏਗੀ ਉਹ ਉਹਦੇ ਚ ਦਸ ਰੁਪਏ ਕਿਲੋਮੀਟਰ ਦੇ ਹਿਸਾਬ ਤੇ ਖਰਚਾ ਪੈਂਦਾ ਹੁੰਦਾ ਤੇ ਕਿਹੜੇ ਪਾਸੇ ਕਿਹੜੀ ਮਾਤਾ ਤੇ ਘੁੰਮਣ ਜਾਣਾ ਤੁਸੀਂ ਇਥੇ ਸਾਰੇ ਪਾਸੇ ਹੋ ਕੇ ਆਣਾ ਅੱਛਾ ਜੀ ਖਾਣੇ ਤੇ ਉੱਥੇ ਬਹੁਤ ਵਧੀਆ ਜੀ ਸਾਰਾ ਕੁਝ ਵਧੀਆ ਹੀ ਮਿਲਦਾ ਔਰ ਰੁਕਣ ਵਾਸਤੇ ਵੀ ਧਰਮਸ਼ਾਲਾ ਬਣੀ ਹੋਈਆ ਨੇ ਉਥੇ ਫਰੀ ਆਫ ਕੋਸਟ ਵੀ ਹੈਗੇ ਨੇ ਤੁਹਾਡਾ ਕਿਹੜੇ ਸ਼ਹਿਰ ਤੋਂ ਆ ਤੁਸੀਂ ਠੀਕ ਐ ਲੁਧਿਆਣੇ ਵੀ ਧਰਮਸ਼ਾਲਾ ਉਹਨਾਂ ਨੇ ਬਣਾਈਆਂ ਹੋਈਆਂ ਨੇ ਉਥੇ ਤੁਸੀਂ ਠਹਿਰ ਸਕਦੇ ਹੋ ਉਥੇ ਕੋਈ ਖਰਚਾ ਵੀ ਨਹੀਂ ਲੱਗਦਾ ਧਰਮਸ਼ਾਲਾ 'ਚ ਰੁਕਣ ਦਾ ਔਰ ਵਧੀਆ ਤੁਸੀਂ ਘੁੰਮ ਸਕਦੇ ਹੋ ਬੜੇ ਆਰਾਮ ਨਾਲ ਰਹਿ ਸਕਦੇ ਹੋ ਖਾਣਾ ਪੀਣਾ ਵੀ ਬਹੁਤ ਵਧੀਆ ਮਿਲਦਾ ਪਰ ਮੇਰੇ ਤਾਂ ਵਹੀਕਲ ਦੇ ਵਿੱਚ ਤਾਂ ਤੁਸੀਂ ਅਗਰ ਦੇਖੋ ਤਾ ਵੀਕਲ ਦਾ ਕੋਈ ਜਿਆਦਾ ਖਰਚਾ ਤਾਂ ਨਹੀਂ ਬਸ ਦਸ ਰੁਪਏ ਅਸੀਂ ਮਤਲਵ ਲਗਾ ਦਿਆਂਗੇ ਵੈਸੇ ਅਸੀਂ ਬਾਰਾਂ ਤੇਰਾਂ ਰੁਪਏ ਕਿਲੋਮੀਟਰ ਦੇ ਹਿਸਾਬ ਤੇ ਰੇਟ ਚਲਦਾ ਤੁਹਾਨੂੰ ਜੇ ਸਾਰੇ ਪਾਸੇ ਘੁੰਮਣਾ ਤਾ ਫਿਰ ਥੋੜਾ ਘੱਟ ਕਰ ਲਾਂਗੇ ਤੁਹਾਡੇ ਨਾਲ ਹੋਰ

ਨਹੀਂ ਨਹੀਂ ਕੋਈ ਨੀ ਆਉਂਦੀ ਵਧੀਆ ਸੜਕਾਂ ਵਧੀਆ ਬਣੀਆਂ ਗਈਆਂ ਤੁਹਾਨੂੰ ਵਧੀਆ ਗੱਡੀ ਨਵੀਂ ਗੱਡੀ ਲਈ ਆਪਾਂ ਨਵੀਂ ਗੱਡੀ ਤੇ ਤੁਹਾਨੂੰ ਘਵਾਵਾਂਗੇ ਨਵੀਂ ਕੈਬ ਪਾਈ ਸਾਡੇ ਚਾਰਜ ਚਾਰ ਜੀਆਂ ਤੇ ਤਾਂ ਬਹੁਤ ਵਧੀਆ ਰਹੇਗੀ ਔਰ ਕੋਈ ਦਿੱਕਤ ਨਹੀਂ ਆਏਗੀ ਰਸਤੇ ਚ ਵਧੀਆ ਜਾਵਾਂਗੇ ਤੇ ਵਧੀਆ ਈ ਵਾਪਿਸ ਘੁੰਮ ਕੇ ਆਵਾਂਗੇ ਆਪਾਂ ਜਾਣਾ ਕਦੋਂ ਹ ਤੁਸੀਂ ਨਹੀਂ ਬਹੁਤ ਵਧੀਆ ਤੁਸੀਂ ਕੱਲ ਵੇਖ ਲਓ ਜੀ ਜੇ ਤੁਹਾਨੂੰ ਠੀਕ ਲੱਗੇ ਤਾਂ ਮੈਨੂੰ ਦੁਬਾਰਾ ਫੋਨ ਕਰਕੇ ਯੈਸ ਕਰਦੇ ਜੇ ਫਿਰ ਮੈਂ ਕਾਲੀ ਗੱਡੀ ਲੈ ਕੇ ਆ ਜਾਗਾ ਠੀਕ ਹ ਜੀ ਓਕੇ ਮਿਹਰਬਾਨੀ